ਲਾਈਕ ਬੈਡਮਿੰਟਨ ਫੁੱਟਬੋਲ ਕ੍ਰਿਕਟ ਖੋ ਖੋ ਟੀ ਵੀ 'ਤੇ ਮੈਂ ਆਪਣੀ ਫੈਮਲੀ ਨਾਲ ਦੇਖਣਾ ਬਹੁਤ ਪਸੰਦ ਕਰਦੀ ਹਾਂ ਕੋਈ ਵੀ ਖੇਡ ਹੋਵੇ ਜਾਂ ਮੈਂ ਲਾਈਵ ਦੇਖਣੀ ਹੋਵੇ ਜਾਂ ਕਿਵੇਂ ਵੀ ਆ ਕਿਸੇ ਵੀ ਚੀਜ਼ ਕਿਸੇ ਵੀ ਮਤਲਬ ਸ਼ੋਅ 'ਚ ਦੇਖਣੀ ਹੋਵੇ ਤਾਂ ਮੈਂ ਆਪਣੀ ਫੈਮਲੀ ਨਾਲ ਬੈਠ ਕੇ ਦੇਖਦੀ ਹਾਂ ਯੂਟੀਊਬ 'ਤੇ ਅਗਰ ਮੈਂ ਸੈਪਰੇਟਲੀ ਹੋਵਾਂ ਜਾਂ ਮਤਲਬ ਕਿਵੇਂ ਵੀ ਮੈਨੂੰ ਅਲੋਨ ਫੀਲ ਹੋ ਰਿਹਾ ਹੋਵੇ ਜਾਂ ਮੈਨੂੰ ਲੱਗ ਰਿਹਾ ਹੋਵੇ ਕਿ ਮੈਂ ਫਰੀ ਬੈਠੀ ਹਾਂ ਜਾਂ ਮੈਨੂੰ ਥੋੜ੍ਹਾ ਟਾਈਮ ਸਪੈਂਡ ਕਰ ਲੈਣਾ ਚਾਹੀਦਾ ਹੈ ਕਿਸੇ ਚੀਜ਼ ਨਾਲ ਤਾਂ ਮੈਂ ਯੂਟੀਊਬ 'ਤੇ ਸੈਪਰੇਟਲੀ ਦੇਖ ਕੇ ਫਿਰ ਮੈਂ ਆਪਣਾ ਦੇਖ ਕਰਦੀ ਹਾਂ ਟਾਈਮ ਸਪੈਂਡ ਅਪ ਉਸ ਤੋਂ ਬਾਅਦ ਮੈਂ ਅਗਰ ਜੇ ਮੈਂ ਲਾਈਵ ਦੀ ਗੱਲ ਕਰਾਂ ਤਾਂ ਲਾਈਵ ਮੈਨੂੰ ਮੇਰੇ ਫਰੈਂਡ ਸਰਕਲ ਦੇ ਨਾਲ ਹੀ ਮੌਕਾ ਮਿਲਦਾ ਹੈ ਦੇਖਣ ਦਾ ਕਿਸੇ ਵੀ ਜਗ੍ਹਾ 'ਤੇ ਜਾ ਕੇ ਜਾਂ ਮਤਲਬ ਕਿਵੇਂ ਵੀ ਕਿਤੇ ਵੀ ਬਾਹਰ ਜਾਣਾ ਕੋਲਜ ਟਾਈਮ ਜਾਂ ਕਿਵੇਂ ਵੀ ਫਰੀ ਟਾਈਮ ਤਾਂ ਮੈਂ ਆਪਣੇ ਦੋਸਤਾਂ ਨਾਲ ਜਾ ਕੇ ਮਤਲਬ ਲਾਈਵ ਜੋ ਹੈ ਉਹ ਦੇਖਣਾ ਪਸੰਦ ਕਰਦੀ ਹਾਂ ਜੋ ਵੀ ਗੇਮਸ ਵਗੈਰਾ ਹੋ ਹੈ ਉਹਨਾਂ ਨੂੰ ਅਤੇ ਇੰਟਰਟੇਨਮੈਂਟ ਵੀ ਹੋ ਜਾਂਦਾ ਇਸ ਨਾਲ